ਸਾਡੇ ਪਠਾਨਕੋਟ ਵਿੱਚ ਕੋਈ ਵੀ ਸਹੂਲਤ ਨਹੀਂ ਹੈ ਸਾਡੀਆਂ ਗਲੀਆਂ ਵੀ ਬਹੁਤ ਮਾੜੀਆਂ ਹਨ ਅਤੇ ਸਾਡੇ ਪਠਾਨਕੋਟ ਦਾ ਹੋਸਪੀਟਲ ਵੀ ਬਹੁਤ ਮਾੜਾ ਹੈ ਕੋਈ ਸਹੂਲਤ ਨਹੀਂ ਹੈ ਟੀਚਰ ਸਰਕਾਰੀ ਸਕੂਲ 'ਚ ਕੋਈ ਟੀਚਰ ਨਹੀਂ ਹੈ ਕੋਈ ਵੀ ਸਹੂਲਤ ਨਹੀਂ ਮਿਲਦੀ ਬੱਚਿਆਂ ਨੂੰ ਸਾਡੀਆਂ ਗਲੀਆਂ ਬਹੁਤ ਮਾੜੀਆਂ ਹੈ ਸੀਵਰੇਜ ਬਹੁਤ ਮਤਲਬ ਗੰਦੇ ਹੈ ਕੋਈ ਸਫਾਈ ਨਹੀਂ ਹੋਤੀ ਮੱਛਰ ਵਗੈਰਾ ਬਹੁਤ ਹੈ ਗਲੀਆਂ ਵਿੱਚ ਜੈਸੇ ਕੋਈ ਵੀ ਸਾਡੀ ਗਲੀ ਵੀ ਕੋਈ ਵੀ ਸਾਫ ਸੂਫ ਨਹੀਂ ਹੈ ਸਾਫ ਸੁਥਰਾ ਕੁਛ ਨਹੀਂ ਹੈ ਸਾਰੇ ਪਠਾਨਕੋਟ ਵਿੱਚ ਬਹੁਤ ਜ਼ਿਆਦਾ ਗੰਦ ਹੈ ਇਸ ਇਸ ਹੋਸਪੀਟਲ ਵਿੱਚ ਵੀ ਕੋਈ ਸਫਾਈ ਨਹੀਂ ਹੁੰਦੀ ਕੋਈ ਸਹੂਲਤ ਨਹੀਂ ਹੈ ਉੱਥੇ ਸਰਕਾਰ ਸਰਕਾਰ ਵਾਲੇ ਕੋਈ ਵੀ ਕੁਛ ਨਹੀਂ ਕਰਦੇ ਐ ਹੋਸਪੀਟਲ ਵਿੱਚ ਵੀ ਨਾ ਸਰਕਾਰੀ ਸਕੂਲਾਂ ਵਿੱਚ ਅਤੇ